ਸਾਡੇ ਖੇਤਰ ਵਿੱਚ ਵਾਤਾਵਰਨ ਸਬੰਧੀ ਹਨ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਾਰਟਿਆ ਸਭ ਤੋਂ ਵੱਡੀ ਚੁਣੌਤੀ ਤਾਂ ਵੱਧ ਰਹੇ ਪ੍ਰਦੂਸ਼ਣ ਦੀ ਮਾਤਰਾ ਹੈ ਹਾਲਾਂ ਕਿ ਅਸੀਂ ਖੁਦ ਵੀ ਜ਼ਿੰਮੇਵਾਰ ਆ ਇਸ ਪ੍ਰਦੂਸ਼ਣ ਵਾਸਤੇ ਕਿਉਂਕਿ ਜਿੰਨੇ ਕੁ ਆਵਾਜਾਈ ਦੇ ਸਾਧਨ ਵੱਧ ਚੁੱਕੇ ਹਨ ਅਤੇ ਜਿੰਨੇ ਕੁ ਰੁੱਖ ਘੱਟ ਚੁੱਕੇ ਹਨ ਅਤੇ ਜਿੰਨਾ ਪ੍ਰਦੂਸ਼ਣ ਵੱਧ ਗਿਆ ਹੈ ਇਹਦੇ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ ਅਤੇ ਲੇਕਿਨ ਸਾਨੂੰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਡਿਆ ਕਿਉਂਕਿ ਸਾਡੀ ਜ਼ਿੰਦਗੀ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਇਹ ਪ੍ਰਦੂਸ਼ਣ ਪ੍ਰਭਾਵਿਤ ਕਰ ਰਿਹਾ ਅਤੇ ਇੱਕ ਹੋਰ ਇੱਕ ਦਿੱਕਤ ਇਹ ਹੈ ਕਿ ਜਿਹੜੀ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਨਾਲ ਜਿਹੜੀ ਲੋਕ ਸਮੋਕਿੰਗ ਵਗੈਰਾ ਮੀਨਜ਼ ਜਿਹੜਾ ਨਸ਼ਾ ਵਗੈਰਾ ਕਰਦੇ ਆ ਬੀੜੀਆਂ ਸਿਗਰਟਾਂ ਪੀਂਦੇ ਆ ਉਹ ਵੀ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅਤੇ ਕਿਉਂਕਿ ਜਿਹੜੇ ਲੋਕ ਇਸ ਤਰ੍ਹਾਂ ਕੁਛ ਨਸ਼ਾ ਵਗੈਰਾ ਪ੍ਰਯੋਗ ਕਰਦੇ ਆ ਉਹ ਆਪਣੇ ਨਾਲ ਨਾਲ ਦੂਸਰਿਆਂ ਨੂੰ ਕਾਫੀ ਜ਼ਿਆਦਾ ਹਾਨੀ ਪਹੁੰਚਾਉਂਦੇ ਆ ਅਤੇ ਲਗਾਤਾਰ ਰੁੱਖਾਂ ਦੀ ਕਟਾਈ ਦੇ ਕਰਕੇ ਜਿਹੜੇ ਔ ਔਕਸੀਜ਼ਨ ਦੀ ਮਾਤਰਾ ਬਿਲਕੁਲ ਘੱਟ ਚੁੱਕੀ ਆ ਅਤੇ ਕਾਰਬਨ ਡਾਈਆਕਸਾਈਡ ਦੀ ਮਤਾਰਾ ਬਹੁਤ ਵੱਧ ਚੁੱਕੀ ਆ ਜਿਹਦੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੜ ਰਿਹਾ ਜਿਵੇਂ ਕਿ ਸਾਹ ਲੈਣ 'ਚ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਅਤੇ ਜਿਹਦੇ ਕਰਕੇ ਅਸਥਮਾ ਨਾਮ ਦੀ ਬਿਮਾਰੀ ਬਹੁਤ ਜ਼ਿਆਦਾ ਪੈਦਾ ਹੋ ਗਈ ਹੈ ਅਤੇ ਇਸ ਕਰਕੇ ਸਾਨੂੰ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਨਵੇਂ ਨਵੇਂ ਪ ਪੌਦੇ ਲਾਉਣੇ ਚਾਹੀਦੇ ਆ ਅਤੇ ਨਵੀਆਂ ਨਵੀਆਂ ਬਨਸਪਤੀ ਨੂੰ ਉਗਾਉਣਾ ਚਾਹੀਦਾ ਹੈ ਤਾਂ ਜੋ ਕਿ ਜਿਹੜੀ ਹਵਾ ਉਹ ਸ਼ੁੱਧ ਹੋ ਸਕੇ ਅਤੇ ਵਾਤਾਵਰਨ ਆਪਣਾ ਸਾਫ਼ ਸੁਥਰਾ ਰਹਿ ਸਕੇ